ਦੁਨੀਆ ਭਰ ਦੀਆਂ ਸਰਕਾਰਾਂ ਭੋਜਨ ਸੁਰੱਖਿਆ ਸਬੰਧੀ ਚਿਤਾਵਾਂ ਨੂੰ ਹੱਲ ਕਰਨ ਲਈ ਮਹੱਤਵਪੂਰਨ ਕਦਮ ਚੁੱਕ ਰਹੀਆਂ ਹਨ ਉਹਨਾਂ ਦੀ ਜਿਹੜੇ ਮੁੱਖ ਨਿਯਮ ਅਤੇ ਮਿਆਰ ਹਨ ਕੋਡੈਕਸ ਐਲੀਮੈਂਟਰੀਅਲ ਖਤਰਾ ਵਿਸ਼ਲੇਸ਼ਣ ਕ੍ਰਿਟੀਕਲ ਕੰਟਰੋਲ ਪੁਆਇੰਟ ਇਸ ਤੋਂ ਇਲਾਵਾ ਜਿਹਦੀ ਸਰਕਾਰੀ ਜਿਹੜੇ ਪਹਿਲ ਕਦਮ ਹਨ ਉਹ ਹਨ ਖੁਰਾਕ ਸੁਰੱਖਿਆ ਅਧੂਨੀਕਰਨ ਐਕਟ ਯੂਰਪੀ੍ਅਨ ਫੂੂਡ ਸੇਫਟੀ ਅਥਾਰਟੀ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਇਹ ਜਿਹੜੇ ਮੇਨ ਆ ਸਰਕਾਰੀ ਜਿਹੜੀ ਪਹਿਲ ਕਦਮੀ ਹਨ ਜੋ ਦੁਨੀਆਂ ਭਰ ਦੀਆਂ ਸਰਕਾਰਾਂ ਭੋਜਨ ਸੁਰੱਖਿਆ ਸਬੰਧੀ ਚਿੰਤਾਵਾਂ ਨੂੰ ਹੱਲ ਕਰਨ ਲਈ ਇੱਕ ਮਹੱਤਵਪੂਰਨ ਦੀ ਕਦਮ ਹੈ ਉਹ ਅਪਣਾ ਰਹੀਆਂ ਹਨ ਮੈਂ ਇੱਕ ਵਾਰ ਦੁਬਾਰਾ ਰਿਪੀਟ ਕਰ ਦਿੰਦਾਂ ਕੋਡੈਕਸ ਐਲੀਮੈਂਟਰੀਅਲ ਖ਼ਤਰਾ ਵਿਸੇਸ਼ਨ ਕ੍ਰਿਟੀਕਲ ਕੰਟਰੋਲ ਪੁਆਇੰਟ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ